ਪੰਜਾਬ ਇੱਕ ਵੱਖ ਵੱਖ ਵੱਖ ਉਹਦੇ ਲਈ ਜ ਸ ਸਿਹਤ ਸੰਭਾਲ ਕਰਮਚਾਰੀ ਜਿੱਦਾਂ ਅਲੱਗ ਅਲੱਗ ਡਾਕਟਰਸ ਨੇ ਜਾਂ ਉਸ ਤੋਂ ਥੱਲੇ ਵਾਲੇ ਕਰਮਚਾਰੀ ਨੇ ਤਾਂ ਸਭ ਦੀ ਦੇਖੋ ਅਲੱਗ ਅਲੱਗ ਯੋਗਤਾ ਉਹਦੇ ਹਿਸਾਬ ਨਾਲ ਆਪਣੇ ਜਿਵੇਂ ਰਿਕਰੂਟਮੈਂਟ ਹੁੰਦੀ ਆ ਉਹਦੇ ਹਿਸਾਬ ਨਾਲ ਅਲੱਗ ਅਲੱਗ ਉਹਨਾਂ ਦਾ ਜੁਆਇਨਿੰਗ ਹੁੰਦੀ ਆ ਅਤੇ ਆਪਾਂ ਜੇ ਮੇਨ ਚੁਣੌਤੀਆਂ ਦੀ ਗੱਲ ਕਰੀਏ ਜਿਹੜੀ ਇਹਨਾਂ ਦੇ ਸਾਹਮਣੇ ਜਿਹੜੀ ਮੇਨ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਆਪਾਂ ਹੁਣ ਦੇਖੀਏ ਤਾਂ ਪੇ ਦੀ ਗੱਲ ਕਰੀਏ ਸਮੇਂ ਸਿਰ ਜਿਹੜੇ ਸ ਸਰਕਾਰੀ ਮੁਲਾਜ਼ਮਾਂ ਇਹਨਾਂ ਨੂੰ ਜਿਹੜੀ ਆਪਣੀ ਮੰਥਲੀ ਇਨਕਮ ਆ ਉਹ ਨਹੀਂ ਮਿਲਦੀ ਇਹ ਇੱਕ ਬਹੁਤ ਵੱਡੀ ਦਿੱਕਤ ਆ ਬਾਕੀ ਆਪਾਂ ਜੇ ਦੇਖੀਏ ਹੁਣ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਜਿਹੜੀਆਂ ਪੋਸਟਾਂ ਨੇ ਕੀ ਹੈ ਅੱਧੀਆਂ ਤਾਂ ਖਾਲੀ ਪਈਆਂ ਨੇ ਆਪਾਂ ਨੂੰ ਪਤਾ ਵੀ ਅੱਜ ਕੱਲ੍ਹ ਜਨਸੰਖਿਆ ਇੰਨੀ ਵੱਧ ਰਹੀ ਆ ਇੰਨਾ ਜ਼ਿਆਦਾ ਰਸ਼ ਹੁੰਦਾ ਆਪਾਂ ਸਰਕਾਰੀ ਹਸਪਤਾਲ ਦਾ ਇੱਕ ਜੇ ਚੱਕਰ ਲਾਈਏ ਕਦੇ ਹੈ ਨਾ ਤਾਂ ਬਹੁਤ ਬੁਰਾ ਹਾਲ ਹੈ ਉੱਥੇ ਪੇਸ਼ੈਂਟ ਦਾ ਤਾਂ ਇੰਨੀਆਂ ਕੀ ਆ ਨਿਯੁਕਤੀਆਂ ਬਹੁਤ ਘੱਟ ਹੋ ਰਹੀਆਂ ਨੇ ਪਰ ਆਪਣੇ ਕੋਲ ਜਿਹੜੇ ਪੇਸ਼ੈਂਟ ਨੇ ਉਹ ਬਹੁਤ ਜ਼ਿਆਦਾ ਨੇ ਤਾਂ ਜਿਹੜੇ ਇਹ ਸਿਹਤ ਸੰਭਾਲ ਕਰਮਚਾਰੀ ਇਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਉਹਨਾਂ ਨੂੰ ਅੱਗੇ ਹੈਂਡਲ ਕਰਨ ਦੇ ਵਿੱਚ ਸਭ ਤੋਂ ਵਧੀ ਵੱਡੀ ਉਦਾਹਰਨ ਆਪਾਂ ਜੇ ਦੇਖੀਏ ਕੋਵਿਡ ਟਾਈਮ ਕੋਵਿਡ ਦੇ ਵਿੱਚ ਦੋ ਸਾਲ ਆਪਾਂ ਜੇ ਦੇਖੀਏ ਤਾਂ ਕੋਈ ਵੀ ਉਦੋਂ ਆਪਣੇ 'ਚੋਂ ਕੋਸ਼ਿਸ਼ ਕਰਦਾ ਸੀ ਇੱਕ ਸਿਹਤਯਾਬ ਬੰਦਾ ਵੀ ਅਸੀਂ ਹਸਪਤਾਲ ਨਾ ਜਾਈਏ ਕਿਉਂਕਿ ਉੱਥੇ ਜਿਹੜਾ ਸਿਹਤਯਾਬ ਬੰਦਾ ਸੀ ਉਹ ਵੀ ਜਾ ਕੇ ਬਿਮਾਰ ਹੋ ਜਾਂਦਾ ਸੀ ਆਪਾਂ ਨੂੰ ਉਦੋਂ ਪਤਾ ਲੱਗਿਆ ਵੀ ਆਪਣਾ ਜਿਹੜਾ ਹੈਲਥ ਸਿਸਟਮ ਆ ਹੈ ਨਾ ਵੀ ਕਿੱਥੇ ਕਿੱਥੇ ਕੀ ਕੀ ਕਮੀਆਂ ਨੇ ਤਾਂ ਕਰਕੇ ਬਹੁਤ ਜ਼ਿਆਦਾ ਸੁਧਾਰ ਦੀ ਲੋੜ੍ਹ ਹੈਗੀ ਇਹਦੇ 'ਚ